ਪੰਜਾਬ ਵਿੱਚ ਨਿਊਜ਼ ਮੀਡੀਆ ਮਨੁੱਖੀ ਅਧਿਕਾਰਾਂ ਅਤੇ ਸਮਾਜਿਕ ਨਿਆਂ ਨਾਲ ਸੰਬੰਧਿਤ ਮੁੱਦਿਆਂ ਨੂੰ ਬੜੇ ਹੀ ਧਿਆਨ ਦੇ ਨਾਲ ਕਵਰੇਜ ਕਰਦਾ ਹੈ ਕਿਉਂਕਿ ਜਿੱਥੇ ਮੀਡੀਆ ਦਾ ਸਮਾਜਿਕ ਫਰਜ਼ ਹੁੰਦਾ ਉੱਥੇ ਨੈਤਿਕ ਫਰਜ਼ ਵੀ ਹੁੰਦਾ ਹੈ ਕਿ ਜਿਹੜੇ ਮਨੁੱਖੀ ਅਧਿਕਾਰਾਂ ਦਾ ਘਾਣ ਨਾ ਹੁੰਦਾ ਹੋਵੇ ਅਤੇ ਮਨੁੱਖੀ ਅਧਿਕਾਰਾਂ ਦੇ ਨਾਲ ਸੰਬੰਧਿਤ ਵੱਖ ਵੱਖ ਸਮਿਆਂ 'ਤੇ ਖ਼ਬਰਾਂ ਅਤੇ ਅਧਿਕਾਰਾਂ ਨਾਲ ਸੰਬੰਧਿਤ ਅਵੇਅਰਨੈਂਸ ਜਿਹੜੀ ਫੈਲਾਉਣਾ ਮੀਡੀਆ ਦਾ ਹੀ ਫਰਜ਼ ਬਣਦਾ ਹੈ ਇਸ ਕਰਕੇ ਕੋਸ਼ਿਸ਼ ਕੀਤੀ ਜਾਂਦੀ ਹੈ ਮੀਡੀਆ ਜ ਵੱਲੋਂ ਵੀ ਅਤੇ ਮੀਡੀਆ ਪਰਸਨ ਹੋਣ ਦੇ ਨਾਂ 'ਤੇ ਆ ਸਾਡੇ ਵੱਲੋਂ ਵੀ ਇਹ ਫਰਜ਼ ਹੁੰਦਾ ਹੈ ਕਿ ਜਿਹੜੇ ਮਨੁੱਖੀ ਅਧਿਕਾਰਾਂ ਦਾ ਜਿਹੜੀ ਸੰਵੇਦਨਸ਼ੀਲਤਾ ਹੈ ਜਾਂ ਸਮਾਜਿਕ ਨਿਆਂ ਜਿਹੜੇ ਸਮਾਜਿਕ ਮੁੱਦਿਆਂ ਦੇ ਉੱਤੇ ਲੋਕਾਂ ਦੇ ਜਿਹੜੇ ਹੱਕ ਦੀ ਆਵਾਜ਼ ਹੈ ਉਹ ਉਠਾਈ ਜਾਵੇ ਇਸ ਕਰਕੇ ਮੀਡੀਆ ਦਾ ਜਿੱਥੇ ਫਰਜ਼ ਬਣਦਾ ਹੈ ਅਤੇ ਜ਼ਿੰਮੇਵਾਰੀ ਵੀ ਬਣਦੀ ਹੈ ਅਤੇ ਜ਼ਿੰਮੇਵਾਰੀ ਦੇ ਨਾਲ ਜਿਹੜਾ ਹੈ ਆਪੇ ਜਿਹੜੇ ਮਨੁੱਖਾਂ ਦੇ ਅਧਿਕਾਰ ਹੁੰਦੇ ਹੈ ਉਹਨਾਂ ਦਾ ਘਾਣ ਨਾ ਹੁੰਦਾ ਹੋਵੇ ਅਤੇ ਸਮਾਜਿਕ ਨਿਆਂ ਦੇ ਵਿੱਚ ਜਿਹੜੀ ਸਮਾਜਿਕ ਨਿਆਂ ਦੇ ਨਾਲ ਸੰਬੰਧਿਤ ਲੋਕਾਂ ਦੇ ਨਾਲ ਸੰਬੰਧਿਤ ਲੋਕਾਂ ਦੀਆਂ ਸਮੱਸਿਆਵਾਂ ਦੇ ਨਾਲ ਸਬੰਧਿਤ ਜਿਹੜੀ ਨਿਊਜ਼ ਕਵਰ ਕਰਦੇ ਹੋਏ ਧਿਆਨ ਰੱਖਿਆ ਜਾਂਦਾ ਕਿ ਮਨੁੱਖ ਦੇ ਅਧਿਕਾਰਾਂ ਦਾ ਜਿੱਥੇ ਹਰਣ ਨਾ ਹੁੰਦਾ ਹੋਵੇ ਮਨੁੱਖ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਜਾਵੇ ਇੱਥੇ ਹੀ ਸਮਾਜ ਪ੍ਰਤੀ ਬਣਦੇ ਮੀਡੀਆ ਦੇ ਫਰਜ਼ ਵੀ ਨਿਭਾਏ ਜਾਣ ਅਤੇ ਸਮਾਜਿਕ ਮੁੱਦਿਆਂ ਨੂੰ ਸੰਵੇਦਨਸ਼ੀਲਤਾ ਦੇ ਨਾਲ ਉਠਾਇਆ ਜਾਵੇ